ਹਾਂਜੀ ਸਾਡੇ ਰੋਪੜ ਸ਼ਹਿਰ ਦੇ ਵਿੱਚ ਪਰਮਾਰ ਹੋਸਪਿਟਲ ਵਿੱਚ ਐਕਸ ਰੇ ਸੀ ਟੀ ਸਕੈਨ ਅਤੇ ਐੱਮ ਆਰ ਆਈ ਸਕੈਨ ਲਈ ਟੂਲ ਮੌਜੂਦ ਹਨ ਜੋ ਕਿ ਖੂਨ ਦੀ ਜਾਂਚ ਪੇਸ਼ਾਬ ਦੀ ਜਾਂਚ ਸੀ ਟੀ ਸਕੈਨ ਬਲੱਡ ਪ੍ਰੈਸ਼ਰ ਆਦਿ ਜਾਂਚ ਔਰ ਸਾਡੇ ਸ਼ਹਿਰ ਵਿੱਚ ਸਰਕਾਰੀ ਹੋਸਪੀਟਲ ਦੇ ਸਾਹਮਣੇ ਕਰਦੇ ਹਨ ਅਤੇ ਸਾਨੂੰ ਕਿਸੇ ਕਿਸਮ ਦੀ ਤਕਲੀਫ ਨਹੀਂ ਹੁੰਦੀ ਕਿਤੇ ਹੋਰ ਪਾਸੇ ਨਹੀਂ ਜਾਣਾ ਪੈਂਦਾ ਅਸੀਂ ਆਪਣੇ ਰੋਪੜ ਸ਼ਹਿਰ ਦੇ ਵਿੱਚ ਹੀ ਕਰਵਾ ਲੈਂਦੇ ਹਾਂ